ਸਾਡੇ ਇਲਾਕੇ ਵਿੱਚ ਉਂਝ ਤਾਂ ਬਹੁਤ ਸਾਰੇ ਧਾਰਮਿਕ ਅਸਥਾਨ ਹਨ ਅਲੱਗ ਅਲੱਗ ਤਰ੍ਹਾਂ ਦੀਆਂ ਮੰਦਰਾਂ ਬਣੀਆਂ ਹੋਈਆਂ ਹਨ ਗੁਰਦੁਆਰੇ ਬਣੇ ਹੋਏ ਹਨ ਹੋਰ ਵੀ ਮਸੀਤਾਂ ਵੀ ਬਣੀਆਂ ਹੋਈਆਂ ਹਨ ਮਸਜਿਦਾਂ ਵੀ ਬਣੀਆਂ ਹੋਈਆਂ ਹਨ ਜਾਂ ਚਰਚ ਵੀ ਬਣੇ ਹੋਏ ਹਨ ਪਰ ਸਾਡੇ ਕੁਝ ਇਲਾਕੇ ਦੇ ਵਿੱਚ ਮਸ਼ਹੂਰ ਜਿਹੜੇ ਇੱਕ ਤਾਂ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਹੈ ਉਸ ਦੀ ਬੜੀ ਮਹਾਨਤਾ ਹੈ ਹਰ ਹਰ ਜਨਵਰੀ ਵਿਸਾਖੀ ਹਰ ਜਨਵਰੀ ਲੋਹੜੀ ਤੋਂ ਇੱਕ ਦਿਨ ਬਾਅਦ ਜਿਹੜਾ ਮੇਲਾ ਭਰਦਾ ਹੈ ਉੱਥੇ ਉਹ ਬੜਾ ਹੀ ਪ੍ਰਸਿੱਧ ਹੈ ਉੱਥੇ ਬਹੁਤ ਸਾਰੇ ਲੋਕ ਜਾਂਦੇ ਹਨ ਮੇਲਾ ਲੱਗਦਾ ਹੈ ਦੂਰੋਂ ਦੂਰੋਂ ਲੋਕ ਵੀ ਆਉਂਦੇ ਹਨ ਅਸੀਂ ਵੀ ਜਿਉਂਦੇ ਹਾਂ ਜਾਂਦੇ ਹਾਂ ਪੂਰੇ ਪਰਿਵਾਰ ਦੇ ਨਾਲ ਆਪਣੇ ਪੂਰੇ ਪਿੰਡ ਦੇ ਕਈ ਬੰਦਿਆਂ ਨੂੰ ਇਕੱਠਾ ਕਰਕੇ ਲੈ ਕੇ ਜਾਂਦੇ ਹਨ ਮੇਰੀਆਂ ਕਈ ਸਹੇਲੀਆਂ ਜਾਂਦੀਆਂ ਹਨ ਅਤੇ ਉਥੋਂ ਸਮਾਨ ਵੀ ਬਹੁਤ ਖਰੀਦ ਕੇ ਲੈ ਕੇ ਆਉਂਦੀਆਂ ਹਨ ਅਤੇ ਦੂਸਰਾ ਸਾਡੇ ਪਿੰਡ ਵਿੱਚ ਹੀ ਨੇੜੇ ਹੀ ਹੈ ਜਮਾਂ ਇੱਕ ਮੰਦਰ ਹੈ ਬਾਬਾ ਸ਼੍ਰੀ ਗੰਗਾ ਰਾਮ ਅਤੇ ਉਸ ਦੀ ਵੀ ਬੜੀ ਮਹਾਨਤਾ ਹੈ ਦੱਸਿਆ ਜਾਂਦਾ ਹੈ ਕਿ ਕੋਈ ਦੋ ਸੌ ਸਾਲ ਪੁਰਾਣਾ ਉਹ ਮੰਦਿਰ ਹੈ ਅਤੇ ਉਹ ਦੋ ਸੌ ਸਾਲ ਹੀ ਬਾਬਾ ਜੀ ਉੱਥੇ ਪ੍ਰਸਿੱਧ ਹੋਏ ਹਨ ਜਾਂ ਉਹਨਾਂ ਦੀ ਉੱਥੇ ਹੀ ਸਮਾਧੀ ਬਣੀ ਹੋਈ ਹੈ ਅਤੇ ਉਹਨਾਂ ਦੀ ਬੜੀ ਮਹੱਤਤਾ ਹੈ ਸਾਡੇ ਇਸ ਪਿੰਡ ਗਿੱਦੜਵਾ ਦੇ ਵਿੱਚ ਬਹੁਤ ਹੀ ਪ੍ਰਸਿੱਧ ਹਨ ਬਹੁਤ ਦੂਰੋਂ ਦੂਰੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਸਟੇਟਸ ਤੋਂ ਅਦਰ ਮੰਗਾਂ ਮੰਗਣ ਆਉਂਦੇ ਹਨ ਇੱਛਾਵਾਂ ਪੂਰੀਆਂ ਕਰਨ ਆਉਂਦੇ ਹਨ ਸਾਡੇ ਇੱਥੇ ਇਲਾਕੇ ਵਿੱਚ ਇਸਾਈ ਧਰਮ ਵੀ ਰਹਿੰਦਾ ਹੈ ਹਿੰਦੂ ਧਰਮ ਵੀ ਰਹਿੰਦਾ ਹੈ ਬਾਣੀਏ ਵੀ ਰਹਿੰਦੇ ਹਨ ਚਮਾਰ ਵੀ ਰਹਿੰਦੇ ਹਨ ਘੁੰਮਿਆਰ ਵੀ ਰਹਿੰਦੇ ਹਨ ਜੱਟ ਫੈਮਿਲੀਜ ਵੀ ਰਹਿੰਦੀਆਂ ਹਨ ਤਾਣਕ ਵੀ ਰਹਿੰਦੇ ਹਨ ਅਤੇ ਉਹ ਅਲੱਗ ਅਲੱਗ ਆਪਦੀ ਚੋਇਸ ਦੇ ਅਕੋਰਡਿੰਗ ਮੰਦਰ ਜਾਂਦੇ ਹਨ ਗੁਰਦੁਆਰੇ ਜਾਂਦੇ ਹਨ ਆਹ ਜਿਵੇਂ ਚਰਚ ਜਾਂਦੇ ਹਨ ਦੋ ਤਿੰਨ ਜਿਵੇਂ ਇੱਕ ਤਾਂ ਸਾਡੇ ਪਿੰਡ ਦੇ ਨਾਲ ਇੱਕ ਹੋਰ ਪਿੰਡ ਹੈ ਕਾਲ ਚਰਾਣੀ ਉੱਥੇ ਇੱਕ ਬਾਬਾ ਜੀ ਹਨ ਉਹਨਾਂ ਦੀ ਬੜੀ ਮਹੱਤਤਾ ਹੈ ਉਹ ਪੁਰਾਣੇ ਸਮਿਆਂ ਦੇ ਵਿੱਚ ਸੀਗੇ ਪਰ ਹੁਣ ਤਾਂ ਨਹੀਂ ਹੈਗੇ ਪਰ ਉਹਨਾਂ ਦਾ ਡੇਰਾ ਜ਼ਰੂਰ ਹੈ ਕਹਿੰਦੇ ਹਨ ਕਿ ਉਸ ਅਕਾਲ ਚਰਾਣੀ ਪਿੰਡ ਦੇ ਵਿੱਚ ਇੱਕ ਅਨੇਕਾਂ ਹੀ ਸਾਲ ਪੁਰਾਣਾ ਸੱਪ ਰਹਿੰਦਾ ਹੈ ਜਿਹੜਾ ਕਿ ਇੱਛਾਵਾਂ ਜਾਂ ਇੱਛਾਵਾਂ ਪੂਰੀਆਂ ਕਰਦਾ ਹੈ ਅਤੇ ਬੁਰਾਈਆਂ ਵੀ ਦੂਰ ਕਰਦਾ ਹੈ ਸਾਡੇ ਇਸ ਇਲਾਕੇ ਦੇ ਵਿੱਚ ਅਲੱਗ ਅਲੱਗ ਧਰਮਾਂ ਨੂੰ ਮੰਨਣ ਵਾਲੇ ਅਲੱਗ ਅਲੱਗ ਸਥਾਨਾਂ ਉੱਤੇ ਜਾਂਦੇ ਹਨ ਸੋ ਧੰਨਵਾਦ